ਹੈਲੋ ਹੈਲੋ ਕੀ ਹਾਲ ਚਾਲ ਸੰਦੀਪ ਵਧੀਆ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ ਕੀ ਕਰੀ ਜਾਂਦੇ ਘਰ ਸਭ ਵਧੀਆ ਮੈਨੂੰ ਕੰਮ ਸੀ ਯਾਰ ਇੱਕ ਮੈਨੂੰ ਮੈਨੂੰ ਰੋਜ਼ ਗੜਸ਼ੰਕਰ ਤੋਂ ਹੁਸ਼ਿਆਰਪੁਰ ਆਉਣਾ ਜਾਣਾ ਬਹੁਤ ਔਖਾ ਲੱਗ ਰਿਹਾ ਆ ਸ਼ਾਮ ਪੈ ਜਾਂਦੀ ਮੈਨੂੰ ਅਤੇ ਮੈਨੂੰ ਕੋਈ ਪੀ ਜੀ ਚਾਹੀਦਾ ਸੀਗਾ ਕਾਲਜ ਦੇ ਨੇੜੇ ਤੇੜੇ ਕੁਛ ਪਤਾ ਕੋਈ ਬੈਸਟ ਪੀ ਜੀ ਮਿਲ ਜਾਏ ਤਾਂ ਜਿੱਦਾਂ ਸਿੰਗਲ ਰੂਮ ਮਿਲ ਜਾਏਗਾ ਮੈਨੂੰ ਅੱਛਾ ਜੀ ਠੀਕ ਹੈ ਠੀਕ ਹੈ ਤੁਸੀਂ ਇੱਕ ਵਾਰ ਜਿੱਦਾਂ ਉਹਨਾਂ ਦਾ ਉੱਥੇ ਜਾ ਕੇ ਦੇਖ ਆਓਂਗੇ ਕਿੱਦਾਂ ਬੈਸਟ ਆ ਕੋਈ ਕਾਲ ਉਹਨਾਂ ਲਈ ਕੋਈ ਫੋਨ ਨੰਬਰ ਵਗੈਰਾ ਮਿਲ ਜਾਵੇ ਅਗਰ ਮੈਨੂੰ ਕਿੱਦਾਂ ਉਹ ਹਾਂਜੀ ਹਾਂਜੀ ਜਿੱਦਾਂ ਉਹ ਟਿਫਨ ਵਗੈਰਾ ਵੀ ਦੇ ਦੇਣਗੇ ਪ੍ਰੋਵਾਈਡ ਕਰ ਦੇਣਗੇ ਜਿੱਦਾਂ ਟਿਫਨ ਸਰਵਿਸ ਵਗੈਰਾ ਉਹ ਪੀ ਜੀ ਵਾਲੇ ਹੀ ਓਕੇ ਓਕੇ ਓਕੇ ਠੀਕ ਹੈ ਠੀਕ ਹੈ ਮੈਨੂੰ ਇਹ ਬਹੁਤ ਜ਼ਿਆਦਾ ਪ੍ਰੋਬਲਮ ਅੱਛਾ ਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਮੈਨੂੰ ਬਹੁਤ ਪ੍ਰੋਬਲਮ ਆ ਰਹੀ ਸੀ ਯਾਰ ਇਸ ਚੀਜ਼ ਦੀ ਅਤੇ ਮੇਰਾ ਆਉਣਾ ਜਾਣਾ ਰੋਜ਼ ਦਾ ਕਰਾਇਆ ਬੱਸ ਦਾ ਸ਼ਾਮ ਪੈ ਜਾਂਦੀ ਆ ਇਸ ਲਈ ਮੈਨੂੰ ਬਹੁਤ ਜ਼ਿਆਦਾ ਲੋੜ ਹੈਗੀ ਹੈ ਫਿਰਰ ਦੁਬਾਰਾ ਆਉਣਾ ਜਾਣਾ ਹਾਂਜੀ ਬਿਲਕੁਲ ਬਹੁਤ ਥੱਕ ਹੁੰਦਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤਾਂ ਹੀ ਮੈਂ ਪੀ ਜੀ ਲੱਭ ਰਹੀ ਹਾਂ ਫਿਰ ਵੀ ਤੁਸੀਂ ਉੱਥੇ ਇੱਕ ਵਾਰ ਜਾ ਕੇ ਦੇਖਿਓ ਨਾ ਜਿੱਦਾਂ ਮੈਨੂੰ ਥੋੜ੍ਹਾ ਬੈਸਟ ਜਿਹਾ ਚਾਹੀਦਾ ਮਾਹੌਲ ਵਗੈਰਾ ਆਲੇ ਦੁਆਲੇ ਦਾ ਜਿੱਦਾਂ ਸ਼ੋਰ ਸ਼ਰਾਬਾ ਨਹੀਂ ਹਾਂਜੀ ਹਾਂਜੀ ਤੁਸੀਂ ਇੱਕ ਵਾਰ ਦੇਖ ਵੀ ਲੈਣਾ ਅਤੇ ਮੈਨੂੰ ਉਹਨਾਂ ਦਾ ਨੰਬਰ ਵਗੈਰਾ ਹੈ ਨਾ ਜਿੱਦਾਂ ਟਿਫਨ ਸਰਵਿਸ ਵੀ ਦੇਖ ਲੈਣਾ ਉੱਥੇ ਕਿੱਦਾਂ ਬੈਸਟ ਆ ਜੋ ਵੀ ਆ ਹੈ ਨਾ ਹਾਂਜੀ ਨਹੀਂ ਨਹੀਂ ਨਹੀਂ ਨਹੀਂ ਨਹੀਂ ਬਿਲਕੁਲ ਨਹੀਂ ਵੈੱਜ ਵੈੱਜ ਹਾਂਜੀ ਵੈਜੀਟੇਰੀਅਨ ਹੀ ਹਾਂ ਮੈਂ ਹਾਂਜੀ ਇੱਦਾਂ ਹੀ ਕੁਛ ਸਿੰਪਲ ਰੋਟੀ ਵਗੈਰਾ ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਤੁਸੀਂ ਮੈਨੂੰ ਉਹਨਾਂ ਦਾ ਨੰਬਰ ਵੀ ਸੈਂਡ ਕਰ ਦਿਓ ਹੈ ਨਾ ਜਿੱਦਾਂ ਮੈਂ ਕਾਲ ਕਰ ਲਵਾਂਗੀ ਉਹਨਾਂ ਨੂੰ ਜੋ ਵੀ ਫੋਨ ਨੰਬਰ ਹੋਏਗਾ ਤੁਹਾਡੇ ਤੋਂ ਤੁਸੀਂ ਮੈਨੂੰ ਸਨੈਪਸ ਵਗੈਰਾ ਵੀ ਸੈਂਡ ਕਰ ਦਿਓ ਇੱਕ ਵਾਰ ਵਟਸਅਪ ਵਗੈਰਾ ਹਾਂ ਹਾਂਜੀ ਹਾਂਜੀ ਓਕੇ ਓਕੇ ਠੀਕ ਹੈ ਠੀਕ ਹੈ ਸੰਦੀਪ ਥੈਂਕ ਯੂ ਥੈਂਕ ਯੂ ਓਕੇ ਓਕੇ